ਸਾਡੇ ਸ਼ਹਿਰ ਵਿੱਚ ਖਾਣ ਪੀਣ ਲਈ ਆਦੀ ਰੈਸਟੋਰੈਂਟ ਦੁਕਾਨਾਂ ਢਾਬੇ ਖੁੱਲ੍ਹੇ ਹੋਏ ਹਨ ਪਰ ਸਭ ਤੋਂ ਵਧੀਆ ਇਸ ਜਗ੍ਹਾ 'ਤੇ ਜੱਗੀ ਸਵੀਟਸ ਹੈ ਜੋ ਕਿ ਸਾਡੇ ਸ਼ਹਿਰ ਦੇ ਨੰਬਰ ਪੰਜ ਰੈਸਟੋਰੈਂਟ ਵਿੱਚੋਂ ਆਉਂਦਾ ਹੈ ਇਸ ਦੀ ਖ਼ਾਸੀਅਤ ਬਟਰ ਚਿਕਨ ਹੈ ਅਤੇ ਨਾਲ ਇੱਕ ਨਾਨ ਅਸੀਂ ਅਸੀਂ ਵੀ ਭੁੱਖ ਦੇ ਮਾਰੇ ਆਪਣੇ ਔਨਲਾਈਨ ਐਪ ਜਰੀਏ ਸਵੀਗੀ ਤੋਂ ਆਹ ਮੰਗਵਾ ਲਿਆ ਇਸਦਾ ਬਿੱਲ ਪੂਰਾ ਪੰਜ ਸੌ ਪੰਝੱਤਰ ਰੁਪਏ ਬਣਿਆ ਸੀ ਅਤੇ ਅਸੀਂ ਆਹ ਜਾਣਨਾ ਚਾਹੁੰਦੇ ਹਾਂ ਕਿ ਆਹ ਖਾਣਾ ਕਦੋਂ ਤੱਕ ਆਏਗਾ ਕਿਉਂਕਿ ਐਪ ਵਿੱਚ ਇੱਕ ਸਮੱਸਿਆ ਕਾਰਨ ਸਾਨੂੰ ਡਿਲੀਵਰੀ ਦਾ ਟਾਈਮ ਸ਼ੋਅ ਨਹੀਂ ਹੋ ਰਿਹਾ ਅਤੇ ਅਸੀਂ ਭੁੱਖ ਮਾਰੇ ਇੱਕ ਤਰ੍ਹਾਂ ਫੋਨ ਕਰ ਕੇ ਦੱਸਣਾ ਚਾਹੁੰਦੇ ਹਨ ਪੁੱਛਣਾ ਚਾਹੁੰਦੇ ਹਾਂ ਕਿ ਆਹ ਸਾਡਾ ਖਾਣਾ ਕਦੋਂ ਤੱਕ ਆਏਗਾ ਸਾਡਾ ਘਰ ਇੱਧਰੋਂ ਤ੍ਰਿਪੜੀ ਟਾਊਨ ਵਿੱਚ ਹੈ ਜੋ ਕਿ ਜੱਗੀ ਸਵੀਟਸ ਤੋਂ ਪੰਜ ਕਿਲੋਮੀਟਰ ਦੂਰ ਹੈ ਤਾਂ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਦੱਸ ਦੇਵੋ ਕਿ ਸਾਡਾ ਖਾਣਾ ਕਦੋਂ ਤੱਕ ਆਏਗਾ